ਰਿਟਾਇਰਮੈਂਟ ਤੋਂ ਬਾਅਦ ਮੇਰਾ ਜੀਵਨ ਬਹੁਤ ਵਧੀਆ ਚੱਲ ਰਿਹਾ ਅਤੇ ਮੈਂ ਮੈਨੂੰ ਪੈਨਸ਼ਨ ਵੀ ਠੀਕ ਲੱਗ ਗਈ ਹੈ ਅਤੇ ਮੇਰਾ ਆਪਣਾ ਪ੍ਰਾਈਵੇਟ ਕੰਮ ਹੈ ਢਾਬਾ ਮੇਨ ਰੋਡ 'ਤੇ ਚੱਲ ਰਿਹਾ ਹੈ ਵਧੀਆ ਸਿਸਟਮ ਗੇਲ ਅਤੇ ਮੈਂ ਆਪਣੀ ਖੇਤੀ ਵੀ ਕਰਦਾ ਅਤੇ ਆਪਣੀ ਬਾਗਬਾਨੀ ਵੀ ਸਬਜ਼ੀ ਸ ਸਾਰੀ ਆਪਣੀ ਕਰਕੇ ਅਸੀਂ ਆਪਣੀ ਸਾਫ ਸੁਥਰੀ ਖਾਂਦੇ ਹਾਂ ਅਤੇ ਦਵਾਈਆਂ ਵਾਲੀਆਂ ਸਬਜ਼ੀਆਂ ਤੋਂ ਬਚਿਆ ਜਾ ਬਚਿਆ ਜਾ ਸਕ ਸਕਦੇ ਹਨ